ਹਰ ਇੱਕ ਹਾਊਸਵਾਈਫ ਨੂੰ ਆਪਣਾ ਆਪਣੇ ਗੁਜ਼ਾਰੇ ਲਈ ਆਪਣਾ ਮਤਲਬ ਕਿ ਉਹ ਕਰਨ ਲਈ ਛੋਟਾ ਜਿਹਾ ਕਾਰੋਬਾਰ ਚਲਾਉਣਾ ਚਾਹੀਦਾ ਹੈ ਮਤਲਬ ਆਪਣਾ ਹੁਨਰ ਦਿਖਾਉਣ ਦੇ ਲਈ ਇਹ ਕਾਰੋਬਾਰ ਚਲਾਉਣਾ ਚਾਹੀਦਾ ਹੈ ਅਤੇ ਇਸ ਵਿੱਚ ਆਪਣਾ ਮਤਲਬ ਕਿ ਹੁਨਰ ਦਿਖਾਇਆ ਜਾ ਸਕਦਾ ਅਤੇ ਆਪਣੇ ਪਰਿਵਾਰ ਨੂੰ ਵੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਅਤੇ ਤ ਆਪਣੇ ਆਪਣੇ ਲਈ ਮਤਲਬ ਜੋ ਵੀ ਕੁਝ ਲੈਣਾ ਹੈਗਾ ਤਾਂ ਆਪਾਂ ਆਪਣੀ ਮਿਹਨਤ ਕਰਕੇ ਲੈ ਵੀ ਸਕਦੇ ਹਾਂ ਇਸ ਵਿੱਚ ਕੱਪੜੇ ਦਾ ਕਾਰੋਬਾਰ ਇਸ ਤਰ੍ਹਾਂ ਹੈ ਮਤਲਬ ਫੈਸ਼ਨ ਦੇ ਤੌਰ 'ਤੇ ਵੀ ਕੁਛ ਵੀ ਆਪਾਂ ਤਿਆਰ ਕਰ ਸਕਦੇ ਹਾਂ ਵਧੀਆ ਕਰ ਸਕਦੇ ਹਾਂ ਅਤੇ ਜਿਵੇਂ ਕਿ ਕੱਪੜੇ ਦਾ ਮਤਲਬ ਫੈਕਟਰੀਆਂ ਲਈ ਵੀ ਕੰਮ ਕਰਦੇ ਹਾਂ ਫੈਸ਼ਨ ਬਰੈਂਡ 'ਤੇ ਕਰ ਕਰਦੇ ਹਾਂ ਵੱਡੇ ਵੱਡੇ ਮਤਲਬ ਫਿਲਮ ਸਟਾਰ ਐਕਟਰਸ ਐਕਟਰਸ ਮਤਲਬ ਕਿ ਵਧੀਆ ਬਰੈਂਡ ਦੇ ਕੱਪੜੇ ਪਾਉਂਦੇ ਨੇ ਉਹਨਾਂ ਦੇ ਡਰੈਸਾਂ ਤਿਆਰ ਕਰਦੇ ਹਾਂ ਇਹ ਸਾਰਾ ਸਟਿਚਿੰਗ ਦੇ ਵਿੱਚ ਹੀ ਆਉਂਦਾ ਹੈ ਅਤੇ ਇਹ ਕਮੀਜ਼ ਆ ਜਿਵੇਂ ਇੱਕ ਕਮੀਜ਼ ਹੋ ਗਿਆ ਕਮੀਜ਼ ਦੀ ਸਟੀਚਿੰਗ ਕੱਪੜੇ ਦੀ ਕਮੀਜ਼ ਤਿਆਰ ਕੀਤਾ ਤਾਂ ਸਿੰਪਲ ਕਮੀਜ਼ ਦਾ ਆਪਾਂ ਇੱਕ ਇਕੱਲੇ ਇੱਕ ਸਿੰਪਲ ਕਮੀਜ਼ ਦਾ ਸੌ ਰੁਪਏ ਲੈਂਦੇ ਹਾਂ ਅਤੇ ਇਸ ਵਿੱਚ ਜਦੋਂ ਪਾਈਪਿੰਗ ਵਗੈਰਾ ਤਿਆਰ ਕਰਾਉਣੀ ਆ ਤਾਂ ਡੇਡ ਸੌ ਦੀ ਵਰਕ ਵਾਲਾ ਕਮੀਜ਼ ਹੋਵੇ ਤਾਂ ਡੇਡ ਸੌ ਰੁਪਇਆ ਜੇ ਮਤਲਬ ਬਲਾਉਜ਼ ਵਗੈਰਾ ਕਰਾਉਣਾ ਹੈ ਤਾਂ ਇਸ ਦਾ ਵੀ ਡੇਡ ਸੌ ਜੋ ਸਾੜੀ ਨਾਲ ਪੈਂਦਾ ਹੈ ਅਤੇ ਜੇ ਸਲਵਾਰ ਸੂਟ ਤਿਆਰ ਕਰਾਉਣਾ ਜੇ ਸਿੰਪਲ ਸਲਵਾਰ ਸੂਟ ਤਿਆਰ ਕਰਦੇ ਆਪਾਂ ਉਸਦੇ ਵਿੱਚ ਸਿੰਪਲ ਸਲਵਾਰ ਸੂਟ ਡੇਡ ਸੌ ਰੁਪਇਆ ਤਿਆਰ ਹੁੰਦਾ ਜੇ ਉਸ 'ਤੇ ਪਾਈਪਿੰਗ ਵਗੈਰਾ ਲਾਉਣੀ ਆ ਲੈਸ ਵਗੈਰਾ ਲਗਾਉਣੀ ਆ ਤਾਂ ਦੋ ਸੌ ਰੁਪਇਆ ਜੇ ਮਤਲਬ ਕਿ ਇਕੱਲੀ ਕਮੀਜ਼ 'ਤੇ ਲਾਈਨਿੰਗ ਲਵਾਉਣੀ ਆ ਤਾਂ ਸਾਡੇ ਤਿੰਨ ਸੋ ਜੇ ਪੂਰੇ ਸੂਟ 'ਤੇ ਲਾਈਨਿੰਗ ਲਵਾਉਣੀ ਆ ਤਾਂ ਪੂਰਾ ਪੰ ਚਾਰ ਸੌ ਰੁਪਇਆ ਲਿਆ ਜਾਂਦਾ ਹੈ ਇਹਦੇ ਵਿੱਚੋਂ ਮਤਲਬ ਪਜਾਮੀ ਵਗੈਰਾ ਪਜਾਮੀ ਫਰਾਕ ਸੂਟ ਪਜਾਮੀ ਵਗੈਰਾ ਪਾਈ ਜਾਂਦੀ ਹੈ ਤਾਂ ਛੋਟੀਆਂ ਪਾਈ ਜਾਂਦੀਆਂ ਨੇ ਉਸ ਹਿਸਾਬ ਨਾਲ ਉਸਦਾ ਰੇਟ ਦੱਸਿਆ ਜਾਂਦਾ ਹੈ ਤਾਂ ਮਤਲਬ ਪੈਂਟ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਸੱਤ ਸੌ ਅੱਠ ਸੌ ਰੁਪਈਆ ਪੈਂਟ ਕਮੀਜ਼ ਦਾ ਲਿਆ ਜਾਂਦਾ ਹੈ ਤਾਂ ਇਹ ਵਧੀਆ ਕੀਮਟ ਲਈ ਜਾਂਦੀ ਹੈ ਸੂਟ ਸਿਲਾਈ ਵਿੱਚ ਤਾਂ ਇਹ ਆਪਣਾ ਕਾਰੋਬਾਰ ਚਲਾਉਣ ਲਈ ਮਤਲਬ ਵਧੀਆ ਸਾਧਨ ਹੈ ਜੋ ਮਤਲਬ ਕਿ ਹਾਊਸਵਾਈਫ ਹੁੰਦੀਆਂ ਹਨ ਉਹਨਾਂ ਨੂੰ ਘਰ ਕਾਰੋਬਾਰ ਚਲਾਉਣ ਲਈ ਆਪਣਾ ਇੱਕ ਰੁਜ਼ਗਾਰ ਚਲਾਇਆ ਜਾਂਦਾ ਹੈ